ਖਾਣ ਪੀਣ ਦਾ ਭੋਜਨ ਜਿਵੇਂ ਕਿ ਮੈਨੂੰ ਬਾਜਰੇ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਅਤੇ ਲੱਸੀ ਅਤੇ ਨਾਲ ਮੱਖਣ ਬਹੁਤ ਹੀ ਪਸੰਦ ਹੈ ਖਾਣਾ ਪੀਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਸਾਡਾ ਖਾਣ ਪੀਣ ਦਿਨੋਂ ਦਿਨ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਬੱਟ ਖਾਣਾ ਪੀਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਸਾਨੂੰ ਖਾਣ ਪੀਣ ਦੀਆਂ ਵਸਤੂਆਂ ਵਿੱਚ ਸ਼ੁੱਧ ਤੋਂ ਸ਼ੁੱਧ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਖਾਣ ਪੀਣ ਵਿੱਚ ਜਿਵੇਂ ਕਿ ਰਸਗੁੱਲਾ ਮੈਨੂੰ ਬਹੁਤ ਪਸੰਦ ਹੈ ਗੁਲਾਬ ਜਾਮੁਨ ਮੈਨੂੰ ਬਹੁਤ ਪਸੰਦ ਹੈ ਕਾਜੂ ਕਤਲੀ ਮੈਨੂੰ ਬਹੁਤ ਪਸੰਦ ਹੈ ਜਲੇਬੀ ਮੈਨੂੰ ਬਹੁਤ ਪਸੰਦ ਹੈ ਅਤੇ ਤੰਦੂਰ ਦੀ ਰੋਟੀ ਨਾਲ ਆਲੂ ਮਟਰ ਅਤੇ ਹਰੀ ਚਟਨੀ ਮੈਨੂੰ ਬਹੁਤ ਪਸੰਦ ਹੈ ਲੱਸੀ ਦਹੀਂ ਦੀ ਅਤੇ ਮਿੱਠੀ ਲੱਸੀ ਵੀ ਮੈਨੂੰ ਬਹੁਤ ਪਸੰਦ ਹੈ ਮਿੱਠੀ ਲੱਸੀ ਦਹੀਂ ਦੀ ਬਹੁਤ ਹੀ ਵਧੀਆ ਬਣਦੀ ਹੈ ਅਤੇ ਉਸ ਦੇ ਵਿੱਚ ਹਲਕਾ ਜਿਹਾ ਮਿੱਠਾ ਵੀ ਹੋਣਾ ਚਾਹੀਦਾ ਹੈ ਫਿਰ ਉਸ ਲੱਸੀ ਦਾ ਪੀਣ ਦਾ ਆਨੰਦ ਹੀ ਕੁਝ ਹੋਰ ਹੈ ਮੈਨੂੰ ਵੈਸੇ ਤਾਂ ਸਾਊਥ ਫੂਡ ਵੀ ਬਹੁਤ ਵਧੀਆ ਲੱਗਦੇ ਹਨ ਜਿਵੇਂ ਕਿ ਇਡਲੀ ਡੋਸਾ ਸਾਂਭਰ ਜੋ ਕਿ ਮੈਂ ਹਫ਼ਤੇ 'ਚ ਇੱਕ ਵਾਰ ਖਾਂਦਾ ਵੀ ਹਾਂ ਜਿਵੇਂ ਕਿ ਮੈਂ ਅੱਜ ਪੋਹਾ ਖਾਧਾ ਪੋਹੇ ਦੇ ਵਿੱਚ ਬਿਨਾਂ ਗਿਰੀਆਂ ਤੋਂ ਪੋਹਾ ਜ਼ਿਆਦਾ ਅੱਛਾ ਨਹੀਂ ਬਣਦਾ ਅਗਰ ਉਹਦੇ ਵਿੱਚ ਗਿਰੀਆਂ ਮੂੰਗਫਲੀ ਗਿਰੀ ਪਾ ਦਿੱਤੀ ਜਾਵੇ ਤਾਂ ਉਹ ਬਹੁਤ ਹੀ ਵਧੀਆ ਬਣਦਾ ਹੈ ਗੱਲ ਕਰੀਏ ਇਡਲੀ ਦੀ ਇਡਲੀ ਵੀ ਬਹੁਤ ਹੀ ਸਵਾਦਿਸ਼ ਹੁੰਦੀ ਹੈ ਇਡਲੀ ਬਹੁਤ ਹੀ ਹਲਕਾ ਫੂਡ ਹੁੰਦੀ ਹੈ ਇਹ ਸਾਊਥ ਦੇ ਵਿੱਚ ਤਾਂ ਬ੍ਰੇਕਫਾਸਟ ਵਜੋਂ ਲੋਕ ਇਹਨਾਂ ਨੂੰ ਕਰਦੇ ਹਨ ਬੱਟ ਸਾਡੇ ਪੰਜਾਬੀ ਲੋਕ ਇਸ ਨੂੰ ਸਨੈਕਸ ਦੇ ਰੂਪ ਵਿੱਚ ਖਾਂਦੇ ਹਨ ਸੋ ਮੈਨੂੰ ਖਾਣਾ ਪੀਣਾ ਬਹੁਤ ਹੀ ਪਸੰਦ ਹੈ ਅਤੇ ਮੈਂ ਖਾਣਾ ਪੀਣਾ ਸ਼ੌਂਕ ਨਾਲ ਖਾਂਦਾ ਹਾਂ ਕਿਉਂਕਿ ਖਾਣਾ ਪੀਣਾ ਹੀ ਤੁਹਾਡੇ ਨਾਲ ਜਾਣਾ ਹੈ ਬਾਕੀ ਹੋਰ ਸਭ ਕੁਝ ਇੱਥੇ ਰਹਿ ਜਾਣਾ